ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟੈਕਨੋਲਜੀ ਅਤੇ ਇੰਟਰਨੈੱਟ ਦੇ ਵਧਣ ਦੇ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਬਿਲਕੁਲ ਹੀ ਬਦਲ ਗਈ ਹੈ ਅੱਜਕੱਲ੍ਹ ਟੈਕਨੋਲਜੀ ਦੀ ਮਦਦ ਦੇ ਨਾਲ ਅਸੀਂ ਅੰਗਰੇਜ਼ੀ ਦੇ ਵਿੱਚ ਟਾਈਪ ਕਰਕੇ ਕਿਸ ਉਸ ਨੂੰ ਕਿਸੇ ਵੀ ਭਾਸ਼ਾ ਵਿੱਚ ਬਦਲ ਸਕਦੇ ਹਾਂ ਅਤੇ ਇਸ ਲਈ ਕੋਈ ਪੰਜਾਬੀ ਭਾਸ਼ਾ ਸਿੱਖਣਾ ਨਹੀਂ ਚਾਹੁੰਦਾ ਕਿਉਂਕਿ ਟੈਕਨੋਲੋਜੀ ਦੀ ਮਦਦ ਦੇ ਨਾਲ ਇੰਨੇ ਸੋਫਟਵੇਅਰ ਸਾਨੂੰ ਇੰਟਰਨੈੱਟ 'ਤੇ ਮਿਲ ਜਾਂਦੇ ਨੇ ਕਿ ਸਾਨੂੰ ਇੰਗਲਿਸ਼ ਦੇ ਵਿੱਚ ਹੀ ਟਾਈਪ ਕਰਕੇ ਅਸੀਂ ਉਸ ਨੂੰ ਪੰਜਾਬੀ ਵਿੱਚ ਬਦਲ ਸਕਦੇ ਹੈ ਜੋ ਕਿ ਪੰਜਾਬੀ ਭਾਸ਼ਾ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਜਿਸ ਕਾਰਨ ਅੱਜਕੱਲ੍ਹ ਦੇ ਬੱਚੇ ਪੰਜਾਬੀ ਭਾਸ਼ਾ ਨੂੰ ਸਿੱਖਣਾ ਨਹੀਂ ਚਾਹੁੰਦੇ ਉਹਨਾਂ ਦਾ ਮੰਨਣਾ ਕੀ ਹੈ ਕਿ ਸਾਨੂੰ ਅੰਗਰੇਜ਼ੀ ਭਾਸ਼ਾ ਸਿੱਖਣੀ ਜ਼ਿਆਦਾ ਜ਼ਰੂਰੀ ਹੈ ਅਤੇ ਅਸੀਂ ਟੈਕਨੋਲੋਜੀ ਅਤੇ ਇੰਟਰਨੈੱਟ ਦੇ ਮਾਧਿਅਮ ਦੇ ਨਾਲ ਇਸ ਨੂੰ ਪੰਜਾਬੀ ਭਾਸ਼ਾ 'ਚ ਵੀ ਬਦਲ ਸਕਦੇ ਹਾਂ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਹਰੇਕ ਹੀ ਜਗ੍ਹਾ ਪਹਿਲ ਦੇ ਦਿੱਤੀ ਗਈ ਹੈ ਇੱਥੋਂ ਤੱਕ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਜੋ ਕਲਰਕ ਭਰਤੀ ਕੀਤੇ ਗਏ ਹਨ ਉਹਨਾਂ ਨੂੰ ਵੀ ਪੰਜਾਬੀ ਭਾਸ਼ਾ ਦੀ ਘੱਟ ਹੀ ਜਾਣਕਾਰੀ ਹੈ ਕਿਉਂਕਿ ਟੈਕਨੋਲਜੀ ਦੀ ਮਦਦ ਦੇ ਨਾਲ ਅਸੀਂ ਅੰਗਰੇਜ਼ੀ ਭਾਸ਼ਾ ਟਾਈਪ ਕਰਕੇ ਉਸਨੂੰ ਕਿਸੇ ਵੀ ਭਾਸ਼ਾ ਦੇ ਵਿੱਚ ਬਦਲ ਸਕਦੇ ਹਾਂ ਜੋ ਕਿ ਪੰਜਾਬੀ ਭਾਸ਼ਾ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਅੱਜਕੱਲ੍ਹ ਦਾ ਜੋ ਨੌਜਵਾਨ ਪੀੜ੍ਹੀ ਹੈ ਉਹ ਇਹ ਨਹੀਂ ਚਾਹੁੰਦੀ ਕਿ ਅਸੀਂ ਪੰਜਾਬੀ ਭਾਸ਼ਾ ਸਿੱਖੀਏ ਉਹ ਸੋਚਦੇ ਹਨ ਕਿ ਟੈਕਨੋਲਜੀ ਦੀ ਮਦਦ ਦੇ ਨਾਲ ਅਸੀਂ ਅੰਗਰੇਜ਼ੀ ਨੂੰ ਹੀ ਪੰਜਾਬੀ ਵਿੱਚ ਬਦਲ ਸਕਦੇ ਹਾਂ ਬਾਕੀ ਇੰਟਰਨੈੱਟ ਦੇ ਵਧਣ ਦੇ ਨਾਲ ਪੰਜਾਬੀ ਭਾਸ਼ਾ ਦਾ ਜਿਹੜਾ ਸਥਾਨ ਹੈ ਉਹ ਉੱਚਾ ਵੀ ਗਿਆ ਹੈ ਜਿਵੇਂ ਕਿ ਹੋਰ ਦੇਸ਼ਾਂ ਦੇ ਲੋਕ ਵੀ ਇੰਟਰਨੈੱਟ ਦੇ ਮਾਧਿਅਮ ਦੇ ਨਾਲ ਪੰਜਾਬੀ ਨੂੰ ਪੜ੍ਹ ਸਕਦੇ ਹਨ ਜਿਨ੍ਹਾਂ ਨੇ ਕਦੇ ਪੰਜਾਬੀ ਭਾਸ਼ਾ ਸੁਣੀ ਵੀ ਨਹੀਂ ਜਾਂ ਦੇਖੀ ਵੀ ਨਹੀਂ ਉਹ ਇੰਟਰਨੈੱਟ ਦੇ ਮਾਧਿਅਮ ਦੇ ਨਾਲ ਪੰਜਾਬੀ ਦੇ ਸਾਰੇ ਲਿਪੀ ਦੇ ਜਿੰਨੇ ਵੀ ਮੁੱਖ ਅੰਗ ਹਨ ਉਹਨਾਂ ਨੂੰ ਪੜ੍ਹ ਸਕਦੇ ਹਨ ਅਤੇ ਜਦੋਂ ਉਹ ਪੰਜਾਬ ਆਉਂਦੇ ਹਨ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ ਤਾਂ ਉਹਨਾਂ ਨੂੰ ਪੰਜਾਬੀ ਸਮਝਣੀ ਜੋ ਕੀ ਕਿਸੇ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਲਿਖੀ ਹੁੰਦੀ ਹੈ ਜਾਂ ਰਸਤੇ ਦੇ ਵਿੱਚ ਵੀ ਜੋ ਬੋਰਡ ਲੱਗੇ ਹੁੰਦੇ ਹਨ ਕਿ ਇਹ ਜਗ੍ਹਾ ਇੰਨੀ ਦੂਰੀ 'ਤੇ ਹੈ ਤਾਂ ਉਹਨਾਂ ਨੂੰ ਪੰਜਾਬੀ ਪੜ੍ਹਨੀ ਜਾਂ ਸਮਝਣੀ ਬਿਲਕੁਲ ਨਹੀਂ ਮੁਸ਼ਕਿਲ ਲੱਗਦੀ ਪੰਜਾਬੀ ਜੇ ਉਹ ਨਹੀਂ ਪੜ੍ਹ ਪਾਉਂਦੇ ਤਾਂ ਉਹ ਸਮਝ ਜ਼ਰੂਰ ਸਕਦੇ ਨੇ ਜੋ ਕਿ ਇੱਕ ਪੰਜਾਬੀ ਭਾਸ਼ਾ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਉਹਨਾਂ ਨੂੰ ਉਹ ਭਾਸ਼ਾ ਸਿੱਖਣੀ ਬਹੁਤ ਹੀ ਜ਼ਿਆਦਾ ਆਸਾਨ ਲੱਗਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਹੈ ਜੋ ਉਹ ਇੰਨੀ ਵਿਲੱਖਣ ਭਾਸ਼ਾ ਹੈ ਕਿ ਜੇ ਕੋਈ ਸਿੱਖਣਾ ਚਾਹੇ ਤਾਂ ਇਸ ਭਾਸ਼ਾ ਨੂੰ ਬਹੁਤ ਜਲਦੀ ਸਿੱਖਿਆ ਜਾ ਸਕਦਾ ਹੈ